ਮੈਂ ਸਿਖਲਾਈ ਸਿਲਾਈ ਦਾ ਕੋਰਸ ਕੀਤਾ ਹੋਇਆ ਹੈ ਇੱਕ ਵਾਰੀ ਮੈਂ ਸਿਲਾਈ ਦੇ ਕੋਰਸ ਕਰਦੇ ਸਮੇਂ ਬੱਚੇ ਦੀ ਫਰਾਕ ਬਣਾਉਣੀ ਸੀ ਮੈਨੂੰ ਐਹ ਪ੍ਰੋਜੈਕਟ ਮਿਲਿਆ ਹੋਇਆ ਸੀ ਇਸ ਨੂੰ ਬਣਾਉਣ ਸਮੇਂ ਮੈਨੂੰ ਬਹੁਤ ਹੀ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਵਾਰੀ ਜਦੋਂ ਮੇਰੀ ਸਮੱਸਿਆ ਉਸ ਸਮੇਂ ਆ ਗਈ ਜਦੋਂ ਉਸ ਵਿੱਚ ਚੁੰਮਟਾ ਪਾਣੀਆਂ ਸੀ ਅਤੇ ਥੱਲੇ ਇੱਕ ਲਾਈਨਿੰਗ ਵੀ ਲਾਉਣੀ ਸੀ ਚੁੰਮਟਾ ਪਾਉਣ ਸਮੇਂ ਉਹ ਕੱਪੜਾ ਇਹੋ ਜਿਹਾ ਸੀ ਕਿ ਜਿਹਦੇ ਨਾਲ ਚੁੰਮਟਾ ਬਣ ਹੀ ਨਹੀਂ ਸੀ ਰਹੀਆਂ ਫਿਰ ਮੈਨੂੰ ਮੇਰੀ ਜਿਹੜੀ ਮਾਸਟਰਨੀ ਸੀ ਉਹਨੇ ਮੈਨੂੰ ਸਮਝਾਇਆ ਕਿ ਇਸ ਚੁੰਮਟਾ ਨੂੰ ਤੂੰ ਕਿਸ ਤਰ੍ਹਾਂ ਠੀਕ ਕਰ ਸਕਦੀ ਹਾਂ ਤਾਂ ਕਿ ਤੈਨੂੰ ਮੈਨੂੰ ਉਸ ਚੁੰਮਟਾ ਨੂੰ ਠੀਕ ਕਰਨ ਲਈ ਥੱਲੇ ਇੱਕ ਉਹਦਾ ਇੱਕ ਹੋਰ ਕੱਪੜਾ ਲਗਾਉਣਾ ਪਿਆ ਉਸ ਚੁੰਮਟਾਂ ਨੂੰ ਜਦੋਂ ਮੈਂ ਠੀਕ ਕਰ ਲਿੱਤਾ ਅਤੇ ਉਸ ਫਰਾਕ ਨੂੰ ਉੱਪਰ ਬਣਾਉਣ ਸਮੇਂ ਉਹਦੇ ਕਾਲਰ ਉੱਤੇ ਵੀ ਬੜੀ ਮੁਸ਼ਕਿਲ ਆਈ ਉਹਦੀਆਂ ਬਾਹਵਾਂ ਜਦੋਂ ਬਣਾਉਣੀਆਂ ਸਨ ਅਤੇ ਬਾਵਾਂ ਦੇ ਉੱਤੇ ਮੈਨੂੰ ਬਹੁਤ ਸਾਰਾ ਡਿਜ਼ਾਇਨ ਪਸਾ ਬਣਾਉਣਾ ਪਿਆ ਸੀ ਉਸ ਡਿਜ਼ਾਇਨ ਨੂੰ ਬਣਾਉਣ ਦੇ ਸਮੇਂ ਮੈਨੂੰ ਬਹੁਤ ਮੁਸ਼ਕਿਲਾਂ ਆਈਆਂ ਮੈਂ ਇੱਕ ਦੂਸਰੇ ਬੰਦੇ ਦੀ ਮਦਦ ਲੈ ਕੇ ਉਸ ਨੂੰ ਠੀਕ ਕੀਤੀਆਂ ਅਤੇ ਉਹ ਇੱਕ ਵਾਰੀ ਤਾਂ ਇੱਕ ਇਹੋ ਜਿਹਾ ਸਮੇਂ ਆਇਆ ਕਿ ਜਦੋਂ ਉਸ ਫਰਾਕ ਦੇ ਥੱਲੇ ਘੇਰੇ ਨੂੰ ਲਾਈਨਿੰਗ ਵਿੱਚ ਉਹ ਲਾਈਨਿੰਗ ਬਾਹਰ ਨਜ਼ਰ ਆਉਣ ਲੱਗ ਪਈ ਫਿਰ ਮੇਰੀ ਅਧਿਆਪਕ ਨੇ ਅਤੇ ਮੇਰੇ ਕੁਛ ਹੋਰ ਦੋਸਤਾਂ ਨੇ ਮੈਨੂੰ ਮਿਲ ਕੇ ਸਮਝਾਇਆ ਕਿ ਇਸ ਲਾਈਨਿੰਗ ਨੂੰ ਤੂੰ ਕਿਵੇਂ ਠੀਕ ਕਰ ਸਕਦੀ ਹੈ ਅਤੇ ਮੈਂ ਉਸ ਨੂੰ ਠੀਕ ਕਰ ਦਿੱਤਾ ਅਤੇ ਉਸਨੂੰ ਠੀਕ ਕਰਨ ਤੋਂ ਬਾਅਦ ਮੇਰੀ ਫਰਾਕ ਐਡੀ ਸੋਹਣੀ ਬਣ ਗਈ ਕਿ ਜਿਸਨੂੰ ਉਹ ਜਿਸ ਕੁੜੀ ਲਈ ਮੈਂ ਬਣਾਈ ਸੀ ਉਹ ਕੁੜੀ ਨੇ ਪਾ ਕੇ ਉਸ ਫਰਾਕ ਨੂੰ ਉਹਨੂੰ ਉਹਨੇ ਇੰਨਾ ਹੀ ਸੋਹਣਾ ਲੱਗਾ ਕਿਉਂਕਿ ਉਹਦੇ ਉੱਤੇ ਜਿਹੜਾ ਮੈਂ ਡਿਜ਼ਾਇਨ ਬਣਾਇਆ ਹੋਇਆ ਸੀ ਉਹ ਡਿਜ਼ਾਇਨ ਇੰਨਾ ਸੋਹਣਾ ਸੀ ਉਸ ਡਿਜ਼ਾਇਨ ਦੇ ਉੱਤੇ ਜਿਹੜੀ ਮੈਂ ਉਹਨਾਂ ਦੇ ਉੱਤੇ ਕਢਾਈ ਕੀਤੀ ਹੋਈ ਸੀ ਉਹ ਕਢਾਈ ਵੀ ਬਹੁਤ ਹੀ ਸੋਹਣੀ ਸੀ ਉਸ ਕਢਾਈ ਨੂੰ ਦੇਖ ਕੇ ਮੇਰੇ ਕੋਲ ਮੇਰੇ ਕੋਲ ਬਹੁਤ ਸਾਰੇ ਹੋਰ ਬੱਚੇ ਆ ਗਏ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਜਿਹੜੀ ਇਹ ਫਰਾਕ ਬਣਾਈ ਹੈ ਇਹ ਬਹੁਤ ਹੀ ਸੋਹਣੀ ਹੈ ਇਹ ਇਸ ਅਨੁਭਵ ਤੋਂ ਮੈਂ ਇਹੀ ਸਿੱਖਿਆ ਕਿ ਇਹ ਜਿਹੜੀ ਮੈਂ ਸ ਬਣਾਉਣ ਦਾ ਕੰਮ ਹੈ ਇਹ ਬਹੁਤ ਹੀ ਚੰਗਾ ਹੈ